ਅੱਜ ਕੱਲ੍ਹ ਲੋਕ ਜਿਹੜੇ ਹੈ ਉਹ ਬੜੇ ਹੀ ਵਹਿਮਾਂ ਭਰਮਾਂ 'ਤੇ ਵ ਫਸੇ ਹੋਏ ਐਂ ਜਿਵੇਂ ਕਿ ਮੈਂ ਦੇਖਿਆ ਮੇਰੇ ਆਲ਼ੇ ਦੁਆਲੇ ਇਲਾਕੇ ਵਿੱਚ ਬਹੁਤ ਇਹੋ ਜਿਹੇ ਬੰਦੇ ਨੇ ਜਿਹੜੇ ਬੜੇ ਹੀ ਭੈ ਵਹਿਮਾਂ ਭਰਮਾਂ 'ਤੇ ਨੇ ਜਿਵੇਂ ਕਿ ਬਿੱਲੀ ਦਾ ਰਸਤਾ ਕੱਟਣਾ ਦੇਖੋ ਇਹਦੇ ਨਾਲ਼ ਕੋਈ ਇਹੋ ਜਿਹਾ ਹੈ ਨਹੀਂ ਵੀ ਕੁਝ ਇਹੋ ਜਿਹਾ ਵਹਿਮ ਭਰਮ ਹੈ ਉਹ ਇ ਐਵੇਂ ਦਾ ਜਾਨਵਰ ਆ ਵਿਚਾਰਾ ਉਹਨੇ ਤਾਂ ਆਪਣਾ ਰਸਤਾ ਲੈਣਾ ਹੀ ਆ ਪਰ ਬਿੱਲੀ ਰਸਤਾ ਕੱਟ ਗਈ ਹੈ ਜੀ ਉਹ ਆਪਣਾ ਰਸਤਾ ਚੇਂਜ ਕਰ ਜਾਂਦੇ ਆ ਆਪਣਾ ਰਸਤਾ ਬਦਲ ਜਾਂਦੇ ਹੈ ਛਿੱਕ ਮਾਰਨੀ ਜਿਵੇਂ ਕਿ ਉਹ ਆਪਣਾ ਜੇ ਘਰੋਂ ਨਿਕਲਦੇ ਨੇ ਕੋਈ ਛਿੱਕ ਮਾਰ ਦਿਓ ਜੀ ਸਾਡਾ ਕੰਮ ਖ਼ਰਾਬ ਹੋ ਰਿਹਾ ਨਹੀਂ ਅਸੀਂ ਜਾਣਾ ਨਹੀਂ ਉਹ ਬੈਠੇ ਰਹਿੰਦੇ ਨੇ ਮਿੱਠਾ ਖਾ ਕੇ ਨਿਕਲਣਗੇ ਅਤੇ ਜਿਹੜੇ ਹੈਗਾ ਪੌਣੇ 'ਤੇ ਨਹੀਂ ਤੁਰਨਾ ਪੌਣੇ 'ਤੇ ਤੁਰਾਂਗੇ ਜੀ ਸਾਡਾ ਘਰ ਦਾ ਕੋਈ ਕੰਮ ਜਿਹੜਾ ਅੜਚਨ ਆਉਗੀ ਉਹ ਨਹੀਂ ਤੁਰਦੇ ਮੰਗਲਵਾਰ ਨੂੰ ਕੱਪੜੇ ਨਹੀਂ ਧੋਣਾ ਵੀਰਵਾਰ ਨੂੰ ਮੱਛੀ ਮੀਟ ਨਹੀਂ ਖਾਣੀ ਇਹਦੇ ਨਾਲ਼ ਕੋਈ ਇਹੋ ਜਿਹਾ ਚੀਜ਼ ਨਹੀਂ ਹੁੰਦੀ ਜਿਹੜੀ ਵਹਿਮ ਭਰਮਾਂ 'ਚ ਫਸਣ ਵਾਲੀ ਹੋਵੇ ਹੁਣ ਭੂਤ ਪ੍ਰੇਤਾਂ ਦੀ ਗੱਲ ਲੈ ਲਓ ਅੱਜ ਕੱਲ੍ਹ ਦੁਨੀਆਂ ਕਿੱਥੇ ਤੋਂ ਕਿੱਥੇ ਪਹੁੰਚ ਗਈ ਫਿਰ ਵੀ ਅਸੀਂ ਭੂਤ ਪ੍ਰੇਤਾਂ 'ਤੇ ਅੜੇ ਹੋਏ ਹਾਂ ਇਹੋ ਜਿਹੀ ਕੋਈ ਚੀਜ਼ ਨਹੀਂ ਜਿਹੜੀ ਭੂਤ ਪ੍ਰੇਤ ਹੋਣ ਅਸੀਂ ਵਹਿਮਾਂ ਭਰਮਾਂ ਤੋਂ ਇਹ ਸਾਈਡ 'ਤੇ ਹੋਣਾ ਚਾਹੀਦਾ ਜਦਕਿ ਇਹ ਭਰਮਾਂ 'ਚ ਅਸੀਂ ਫਸੇ ਹੋਏ ਹਾਂ